ਵੈਸੇ ਤੇ ਸਾਰੀ ਰੁੱਤਾਂ ਦੇ ਆਪਣੇ ਆਪਣੇ ਫਾਇਦੇ ਹੈਗੇ ਪਰ ਮੈਨੂੰ ਸਰਦੀਆਂ ਦਾ ਮੌਸਮ ਬਹੁਤ ਪਸੰਦ ਹੈਗਾ ਸਰਦੀਆਂ ਦੇ ਮੌਸਮ ਵਿੱਚ ਬੰਦਾ ਥੋੜ੍ਹਾ ਜਿਹਾ ਜ਼ਿਆਦਾ ਕੰਮ ਕਰ ਸਕਦਾ ਹੈਗਾ ਗਰਮੀਆਂ ਦੇ ਮੌਸਮ ਵਿੱਚ ਸਾਨੂੰ ਪਸੀਨੇ ਆਉਣ ਕਰਕੇ ਕੰਮ ਕਰਨ 'ਤੇ ਬਹੁਤ ਦਿੱਕਤ ਆਉਂਦੀ ਹੈ ਬਾਰਿਸ਼ਾਂ ਵਿੱਚ ਸਮਾਂ ਅਸਮਾਂ ਮੀਹ ਪੈਣ ਕਰਕੇ ਤੁਸੀਂ ਆਪਣੇ ਕੰਮ 'ਤੇ ਲੇਟ ਹੋ ਜਾਂਦੇ ਹੋ ਸਰਦੀਆਂ ਵਿੱਚ ਇਹ ਸਾਰੀ ਦਿੱਕਤ ਨਹੀਂ ਆਉਂਦੀ ਹੈ ਸਰਦੀਆਂ ਵਿੱਚ ਬੰਦਾ ਗਰਮ ਕੱਪੜੇ ਪਾ ਕੇ ਆਰਾਮ ਨਾਲ ਦਫ਼ਤਰ ਆ ਸਕਦਾ ਹੈ